ਮੈਂ ਤੁਹਾਨੂੰ ਇਹ ਚੀਜ਼ ਦੱਸਣਾ ਚਾਹੁੰਦੀ ਹਾਂ ਕਿ ਸਾਡੇ ਘਰ ਦੇ ਵਿੱਚ ਜਿਹੜੀ ਚੀਜ਼ ਨੂੰ ਪਸੰਦ ਕੀਤਾ ਜਾਂਦਾ ਹੈ ਉਹ ਹੈਗੇ ਦਹੀਂ ਭੱਲੇ ਕਿਉਂਕਿ ਜ਼ਿਆਦਾਤਰ ਸਾਡੇ ਘਰ ਦਹੀ ਭੱਲੇ ਬਹੁਤ ਜ਼ਿਆਦਾ ਪਸੰਦ ਕਰਦੇ ਹਨ ਤਾਂ ਫਿਰ ਅਸੀਂ ਘਰ ਹੀ ਬਣਾ ਲੈਂਦੇ ਹਾਂ ਦਹੀਂ ਭੱਲੇ ਤਾਂ ਸੰਡੇ ਨੂੰ ਸਾਰੇ ਘਰ ਹੁੰਦੇ ਹਨ ਅਤੇ ਨਾਲੇ ਆਹ ਛੁੱਟੀਆਂ ਦੇ ਵਿੱਚੀ ਜਿਵੇਂ ਹੁਣ ਆਪਦੇ ਨਾਨਕੇ ਆਉਂਦੇ ਜਵਾਕ ਅਤੇ ਉਹਨਾਂ ਵਾਸਤੇ ਵਧੀਆ ਇਹ ਡਿਸ਼ਾਂ ਤਿਆਰ ਕਰਦੇ ਹੈਗੇ ਅਤੇ ਹੁਣ ਜਿਵੇਂ ਕਿ ਆਹ ਹੁਣ ਛੁੱਟੀਆਂ ਕਰਕੇ ਆਏ ਹੀ ਹੋਏ ਹੈਗੇ ਆਪਣੇ ਵੀ ਆਪਣੇ ਨਾਨਕੇ ਜਾਂਦੇ ਜਵਾਕ ਵਧੀਆ ਉਹ ਅੱਗੇ ਉਹ ਤਾਂ ਡਿਮਾਂਡ ਕਰਦੇ ਆ ਮਾਮੀ ਜੀ ਮੈਂ ਆਹ ਖਾਣਾ ਖਾਣਾ ਗਾ ਤਾਂ ਫਿਰ ਉਹ ਚੀਜ਼ ਕਰਕੇ ਫਿਰ ਦਹੀਂ ਭੱਲੇ ਉਹਨਾਂ ਨੇ ਡਿਮਾਂਡ ਕੀਤੀ ਸੀਗੀ ਤਾਂ ਫਿਰ ਮੈਂ ਉਸ ਉਸ ਦਿਨ ਉਹ ਬਣਾਏ ਆ ਦਹੀਂ ਭੱਲੇ ਇੱਕ ਦਿਨ ਮੈਂ ਦਾਲ ਸਾਰੀ ਭਿਓਂ ਤੀ ਉਹ ਥੋੜ੍ਹੀ ਦਾਲ ਭਿਓਂ ਕੇ ਅਤੇ ਇੱਕ ਦਿਨ ਭਿਓਂ ਰੱਖੀ ਸਾਰਾ ਦਿਨ ਸਾਰੀ ਰਾਤ ਭਿੱਜੀ ਰਹੀ ਦਾਲ ਅਤੇ ਫਿਰ ਉਹ ਤੋਂ ਅਗਲੇ ਦਿਨ ਫਿਰ ਮੈਂ ਉਹ ਦਾਲ ਦੇ ਛਿਲਕਾ ਜਿਹੜਾ ਸੀਗਾ ਲਹਿ ਗਿਆ ਸੀਗਾ ਛਿਲਕਾ ਚੰਗੀ ਤਰ੍ਹਾਂ ਧੋ ਕੇ ਛਿਲਕਾ ਲਾਹ ਤਾ ਸਾਰਾ ਛਿਲਕਾ ਲਾਉਣ ਤੋਂ ਬਾਅਦ ਫਿਰ ਉਹਨੂੰ ਗਰਾਇੰਡ ਕਰ ਲਿਆ ਵੀ ਚੰਗੀ ਤਰ੍ਹਾਂ ਧੋ ਕੇ ਉਹਨੂੰ ਗਰਾਈਂਡ ਕਰ ਲਿਆ ਗਰਾਈਂਡ ਕਰਕੇ ਫਿਰ ਤੇਲ ਪਾ ਕੇ ਕੜਾਹੀ ਦੇ ਵਿੱਚ ਤੇਲ ਨੂੰ ਤੇਲ ਦੇ ਵਿੱਚ ਤਲ ਅਤੇ ਚਮਚੇ ਨਾਲ ਪਾ ਪਾ ਕੇ ਉਹਨਾਂ ਨੂੰ ਤੇਲ 'ਚ ਤਲ ਅਤੇ ਤੇਲ 'ਚ ਤਲਣ ਤੋਂ ਬਾਅਦ ਫਿਰ ਉਹਨਾਂ ਨੇ ਇੱਕ ਪਾਣੀ ਸੀਗਾ ਪਾਣੀ ਲੈ ਕੇ ਕੋਲੇ ਦੇ ਵਿੱਚ ਅਤੇ ਉਹਦੇ ਵਿੱਚ ਛੱਡ ਤੇ ਦੋ ਤਿੰਨ ਮਿੰਟ ਛੱਡਣ ਤੋਂ ਬਾਅਦ ਫਿਰ ਉਹਨਾਂ ਨੂੰ ਬਾਹਰ ਕੱਢ ਲਏ ਅਤੇ ਇੱਕ ਪਾਸੇ ਆਪਾਂ ਦਹੀਂ ਤਿਆਰ ਕਰ ਲਈ ਦਹੀਂ ਇੱਕ ਤਾਂ ਮਿੱਠੀ ਦਹੀਂ ਤਿਆਰ ਕਰ ਲਈ ਵੀ ਥੋੜ੍ਹੀ ਜਿਹੀ ਖੰਡ ਘੋਲ ਕੇ ਅਤੇ ਇੱਕ ਥੋੜ੍ਹੀ ਜਿਹੀ ਵੀ ਠੀਕ ਨੋਰਮਲ ਜਿਹੀ ਲੂਣ ਨਾਲ ਦਹੀਂ ਥੋੜ੍ਹੀ ਸੀਗੀ ਉਹ ਤਿਆਰ ਕਰ ਲਈ ਅਤੇ ਭੁਜੀਆ ਮੱਠੀ ਵਗੈਰਾ ਇਹ ਚੀਜ਼ਾਂ ਲੈ ਆਉਂਦੀਆਂ ਸੀ ਦੁਕਾਨ ਤੋਂ ਇਹ ਪਈਆਂ ਵੀ ਸੀਗੀਆਂ ਅਤੇ ਲੈ ਆਉਂਦੀਆਂ ਸੀਗੀਆਂ ਇਹ ਚੀਜ਼ਾਂ ਚੈਰੀ ਵਗੈਰਾ ਸਾਰਾ ਕੁਝ ਉਹਦੇ ਵਿੱਚ ਫਿਰ ਤਿਆਰ ਕੀਤਾ ਪਾ ਕੇ ਪਹਿਲਾਂ ਉਹ 'ਚ ਦਹੀਂ ਭੱਲੇ ਤੋੜ ਕੇ ਪਾਏ ਫਿਰ ਉਸ ਤੋਂ ਬਾਅਦ ਉਹਦੇ ਉੱਤੇ ਦਹੀਂ ਪਾਈ ਮਿੱਠੀ ਦਹੀਂ ਪਾਈ ਥੋੜ੍ਹੀ ਜਿਹੀ ਅਤੇ ਥੋੜ੍ਹੀ ਨੋਰਮਲ ਜਿਹੀ ਦਹੀਂ ਪਾਈ ਹੈਗੀ ਫਿਰ ਦਹੀਂ ਪਾਉਣ ਤੋਂ ਬਾਅਦ ਫਿਰ ਉਹਦੇ ਵਿੱਚ ਭੁਜੀਆ ਪਾਇਆ ਮੱਠੀ ਪਾਈ ਤੋੜ ਕੇ ਥੋੜ੍ਹੀ ਜਿਹੀ ਫਿਰ ਉਸ ਤੋਂ ਬਾਅਦ ਉਹਦੇ ਵਿੱਚ ਚੈਰੀ ਪਾਈ ਥੋੜ੍ਹਾ ਜਿਹਾ ਨਮਕ ਥੋੜ੍ਹਾ ਜਿਹਾ ਮਸਾਲਾ ਆ ਪਾਇਆ ਚਾਟ ਮਸਾਲਾ ਅਤੇ ਥੋੜ੍ਹਾ ਜਿਹਾ ਬਸ ਚੀਜ਼ਾਂ ਥੋੜ੍ਹਾ ਜਿਹਾ ਪਾਉਣ ਤੋਂ ਬਾਅਦ ਫਿਰ ਉਹ ਤੋਂ ਬਾਅਦ ਥੋੜ੍ਹੀ ਸੋਸ ਪਾਈ ਸੋਸ ਵੀ ਲਿਆਉਂਦੀ ਸੀ ਸੋਸ ਪਾਉਣ ਦੇ ਨਾਲ ਥੋੜ੍ਹਾ ਟੇਸਟ ਵਧੀਆ ਬਣ ਜਾਂਦਾ ਗਾ ਅਤੇ ਫਿਰ ਉਸ ਤੋਂ ਬਾਅਦ ਉਹ ਸਾਰਾ ਕੁਝ ਪਾ ਕੇ ਵਧੀਆ ਤਿਆਰ ਹੋਏ ਅਤੇ ਜਦੋਂ ਉਹਨਾਂ ਨੂੰ ਖਾਣ ਵਾਸਤੇ ਦਿੱਤੀ ਤਾਂ ਮੈਂ ਅਤੇ ਪੂਰਾ ਇੰਨਾ ਜਾ ਇੰਨੀ ਜ਼ਿਆਦਾ ਟੇਸਟੀ ਬਣੀ ਸੀਗੀ ਅਤੇ ਸਾਰੇ ਕਹਿੰਦੇ ਕਹਿੰਦੇ ਬਹੁਤ ਜ਼ਿਆਦਾ ਟੇਸਟੀ ਬਣੀ ਹੈਗੀ ਵੀ ਬਜ਼ਾਰ ਨਾਲੋਂ ਵੀ ਬਹੁਤ ਵਧੀਆ ਬਣੀ ਹੈ ਵੀ ਆਪਦੇ ਘਰੇ ਹੈਲਦੀ ਖਾਣ ਵਾਲੇ ਬਣ ਗਿਆ ਨਾਲੇ ਆਪਦੇ ਵੀ ਨਿਗ੍ਹਾ ਦੇ ਸਾਹਮਣੇ ਬਣ ਗਿਆ ਵੀ ਕਈ ਵਾਰ ਬਾਹਰੋਂ ਖਾਣਾ ਖਾਂਦੇ ਵੀ ਕਈ ਵਾਰ ਪੇਟ ਖਰਾਬ ਜਾਂ ਫਿਰ ਉਹ ਹੋ ਜਾਂਦੇ ਤਾਂ ਇਹ ਤੋਂ ਵਧੀਆ ਘਰ ਇਹ ਚੀਜ਼ਾਂ ਬਣਾ ਕੇ ਖਾ ਲਓ ਤਾਂ ਬਹੁਤ ਵਧੀਆ ਰਹਿੰਦਾ ਗਾ ਅਤੇ ਆਪਦੇ ਘਰ ਦੀ ਵਧੀਆ ਸਫਾਈ ਨਾਲ ਚੀਜ਼ ਜਿਹੜੀ ਬਣੀ ਹੋਵੇਗੀ ਤਾਂ ਖਾਣ ਲਈ ਵੀ ਸਿਹਤ ਸਿਹਤ ਲਈ ਵੀ ਚੰਗੀ ਰਹੇਗੀ ਨਾਲ ਜਿਹੜੀ ਆਪਦੇ ਘਰੇ ਜਿਹੜੀ ਵਧੀਆ ਇੱਕ ਪੂਰੀਆਂ ਛੋਲੇ ਬਣਾਉਂਦੇ ਹੈਗੇ ਪੂਰੀ ਛੋਲੇ ਵੀ ਜਦੋਂ ਆਪਣੇ ਆਪ ਦੇ ਜਿਹੜੇ ਘਰੇ ਬਣਾਉਣੇ ਹੈਗੇ ਵੀ ਵਧੀਆ ਤੇਲ ਵਿੱਚ ਕੱਢ ਕੇ ਬਣਾ ਸਕਦੇ ਹੈਗੇ ਕਿਉਂਕਿ ਜਿਹੜਾ ਬਾਹਰ ਵਾਲਾ ਤੇਲ ਹੁੰਦਾ ਕਈ ਵਾਰ ਸਹੀ ਨਹੀਂ ਹੁੰਦਾ ਵੀ ਉਸੇ ਤੇਲ ਦੇ ਵਿੱਚ ਬਾਰੀ ਬਾਰੀ ਕੱਢੀ ਜਾਂਦੇ ਆ ਆਪਣੇ ਬਸ ਜਿਹੜੇ ਇੱਕ ਵਾਰੀ ਤੇਲ ਯੂਜ ਹੋ ਗਿਆ ਉਸ ਤੋਂ ਬਾਅਦ ਦੂਰੀ ਵਾਰ ਯੂਜ ਕਰਨਾ ਔਖਾ ਮੁਸ਼ਕਿਲ ਹੈਗਾ ਉਹ ਤੇਲ ਵੀ ਖਰਾਬ ਹੀ ਕਰਦਾ ਹਾਨੀਕਾਰਕ ਹੀ ਹੈ ਸਿਹਤ ਲਈ ਇਸ ਕਰਕੇ ਜਿਹੜਾ ਇੱਕ ਵਾਰੀ ਤੇਲ ਜਿਹਦੇ ਕਰਕੇ ਪੂਰੀਆਂ ਛੋਲੇ ਵੀ ਬਹੁਤ ਆਸਾਨੀ ਨਾਲ ਅਤੇ ਸੌਖੀਆਂ ਬਣ ਜਾਂਦੀਆਂ ਨੇ ਉਹਨਾਂ ਵਾਸਤੇ ਬਸ ਚਣਿਆਂ ਦੀ ਦਾਲ ਬਣਾਉਣੀ ਪੈਂਦੀ ਹੈਗੀ ਕਾਲੇ ਛੋਲੇ ਬਣਾ ਕੇ ਅਤੇ ਕਾਲੇ ਛੋਲੇ ਵੀ ਬਹੁਤ ਸੌਖੇ ਹੈਗੇ ਗਰੈਂਡ ਕਰ ਲਏ ਮਸਾਲਾ ਪਿਆਜ ਲਸਣ ਅਦਰਕ ਸਾਰਿਆਂ ਨੂੰ ਗ੍ਰੈਂਡ ਕਰਕੇ ਵਧੀਆ ਤੜਕਾ ਲਾ ਕੇ ਅਤੇ ਵਧੀਆ ਫਿਰ ਉਸ ਨੂੰ ਮਸਾਲਾ ਕਰਕੇ ਅਤੇ ਛੋਲੇ ਆਹ ਚਣੇ ਪਾ ਕੇ ਅਤੇ ਆਲੂ ਪਾ ਕੇ ਅਤੇ ਉਹਨਾਂ ਨੂੰ ਦੋ ਤਿੰਨ ਸੀਟੀਆਂ ਬਣਾ ਕੇ ਅਤੇ ਵਧੀਆ ਹੋ ਜਾਂਦਾ ਆਟਾ ਗੁੰਨ ਕੇ ਪੂਰੀਆ ਬਣ ਕੇ ਉਹ ਵੀ ਬਹੁਤ ਟੇਸਟੀ ਬਣ ਜਾਂਦੀਆਂ ਤਾਂ ਇਹ ਚੀਜ਼ ਬਹੁਤ ਜ਼ਿਆਦਾ ਟੇਸਟੀ ਲੱਗੀ ਤਾਂ ਸਾਡੇ ਜਿਹੜੇ ਆਏ ਸੀਗੇ ਛੁੱਟੀਆਂ ਦੇ ਵਿੱਚ ਛੁੱਟੀਆਂ ਬਿਤਾਉਣ ਵਾਸਤੇ ਤਾਂ ਉਹਨਾਂ ਨੇ ਇਹ ਚੀਜ਼ਾਂ ਬਹੁਤ ਜ਼ਿਆਦਾ ਵਧੀਆ ਲੱਗੀਆਂ ਅਤੇ ਉਹਨਾਂ ਨੇ ਇਹ ਚੀਜ਼ਾਂ ਨੂੰ ਬਹੁਤ ਜ਼ਿਆਦਾ ਲਾਇਕ ਕੀਤਾ ਅਤੇ ਬਹੁਤ ਹੀ ਜ਼ਿਆਦਾ ਇਹਨਾਂ ਨੇ ਵੀ ਆਦਰ ਕੀਤਾ ਥੈਂਕ ਯੂ